ਸਾਡੇ ਪੰਜਾਬ ਖੇਤਰ ਵਿੱਚ ਪ੍ਰਮੁੱਖ ਖੇਡ ਟੀਮਾਂ ਕਬੱਡੀ ਦੀਆਂ ਹਨ ਵੈਸੇ ਹਾਕੀ ਵੀ ਖੇਲੀ ਜਾਂਦੀ ਹੈ ਪਰ ਕਬੱਡੀ ਜਿਹੜੀ ਹੈਗੀ ਹੈ ਅੰਤਰਰਾਸ਼ਟਰੀ ਖੇਡ ਬਣ ਚੁੱਕੀ ਹੈ ਬਾਹਰ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹ ਕਬੱਡੀ ਖੇਲੀ ਜਾਂਦੀ ਹੈ ਮੈਂ ਕਬੱਡੀ ਟੀਮ ਦਾ ਹੀ ਸਮਰਥਨ ਕਰਦੀ ਹਾਂ ਕਿਉਂਕੀ ਸਾਡੇ ਬੱਚੇ ਅੱਜ ਕੱਲ੍ਹ ਕੀ ਆ ਆਊਟਡੋਰ ਇਨਡੋਰ ਜਿਹੜੀਆਂ ਗੇਮਾਂ ਬਹੁਤ ਘੱਟ ਖੇਲਦੇ ਹਨ ਅੰਦਰ ਹੀ ਬੈਠ ਕੇ ਮੋਬਾਇਲ 'ਤੇ ਲੱਗੇ ਰਹਿੰਦੇ ਹਨ ਪਰ ਜਿਹੜੀ ਕਬੱਡੀ ਇੱਕ ਇਹੋ ਜਿਹੀ ਇਹੋ ਜਿਹੀ ਖੇਡ ਹੈ ਜਿਸ ਨਾਲ ਕੀ ਹੈ ਆਪਣੇ ਸਰੀਰ ਦੀ ਸਾਰੀ ਵਰਜਿਸ਼ ਹੁੰਦੀ ਹੈ ਬੱਚਿਆਂ ਦਾ ਕੀ ਹੈ ਖਾਣਾ ਪੀਣਾ ਪਚ ਜਾਂਦਾ ਹੈਗਾ ਔਰ ਬੱਚੇ ਜਿਹੜੇ ਹੈਗੇ ਆ ਬਾਹਰ ਜਾ ਕੇ ਇੱਕ ਸਾਂਝਾ ਭਾਈਚਾਰਕ ਟੀਮ ਬਣਦੀ ਹੈਗੀ ਪਿਆਰ ਵੱਧਦਾ ਉਹਨਾਂ ਦੇ ਵਿੱਚ ਮਿਲਣ ਮਿਲ ਮਿਲਣ ਵਰਤਣ ਦੇ ਜਿਹੜੇ ਹੈਗੇ ਮੌਕੇ ਉਹਨਾਂ ਨੂੰ ਮਿਲਦੇ ਇੱਕ ਦੂਜੇ ਨਾਲ ਔਰ ਸਾਡੇ ਦੇਸ਼ ਦਾ ਜਿਹੜਾ ਨਾਮ ਹੈਗਾ ਪੂਰੇ ਪੰਜਾਬ ਦਾ ਕਬੱਡੀ ਟੀਮ ਨੇ ਹੀ ਨਾਮ ਰੌਸ਼ਨ ਕੀਤਾ ਹੈਗਾ ਅਤੇ ਬ ਸਾਰੇ ਹੀ ਬੱਚਿਆਂ ਨੂੰ ਕਬੱਡੀ ਜਾਂ ਹਾਕੀ ਵੱਲ ਆਉਣਾ ਚਾਹੀਦਾ ਹੈ ਤਾਂ ਜੋ ਅਸੀਂ ਜਿਹੜੇ ਇਹਨਾਂ ਮੋਬਾਈਲਾਂ ਤੋਂ ਸਾਨੂੰ ਛੁਟਕਾਰਾ ਕਬੱਡੀ ਜਿਹੜੀ ਹੈਗੀ ਔਰ ਜੋਸ਼ੀ ਬਰਜਿਸ਼ ਵਾਲੀਆਂ ਗੇਮਾਂ ਹਨ ਟੀਮਾਂ ਖੇਡਾਂ ਹਨ ਇਹੀ ਸਾਨੂੰ ਇਹਨਾਂ ਮੋਬਾਇਲਾਂ ਤੋਂ ਛੁਟਕਾਰਾ ਦਵਾ ਸਕਦੀਆਂ ਤਾਂ ਛੁਟਕਾਰਾ ਦਵਾ ਸਕਦੀਆਂ ਹਨ ਅਤੇ ਤਾਂ ਹੀ ਅਸੀਂ ਆਪਣੇ ਜਿਹੜੇ ਬੱਚਿਆਂ ਨੂੰ ਸਹੀ ਸੇਧ ਦੇ ਸਕਦੇ ਹਾਂ ਤਾਂ ਹੀ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਹੈਗੇ ਹੈ ਫੁੱਟ ਮਜਰੂ ਫੁੱਟ ਜੋ ਮੁੱਛ ਫੁੱਟ ਮੁੱਛ ਜੋ ਗੱਭਰੂ ਹੈਗੇ ਹੈ ਉਹ ਸਿਰਫ ਜੇਕਰ ਇਹ ਖੇਡਾਂ ਖੇਡਣਗੇ ਤਾਂ ਹੀ ਉਹ ਬਲਵਾਨ ਸ਼ਕਤੀਸ਼ਾਲੀ ਹੋਣਗੇ ਤਾਂ ਹੀ ਸਾਡੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਜਾਵੇਗਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਡੇ ਪੰਜਾਬ ਦੀਆਂ ਜੋ ਹੈਗੀਆਂ ਸਾਡੇ ਪੰਜਾਬ ਦਾ ਨਾਂ ਜਿਹੜਾ ਰੌਸ਼ਨ ਹੋਵੇਗਾ